ਪੰਜਾਬ ਦੇ ਅੰਦਰ ਭੰਗੜਾ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਦੇ ਨਾਲ ਜਿਹੜੇ ਸਾਡੇ ਸੰਗੀਤਕਾਰ ਨੇ ਜਿਹੜੇ ਗਾਇਕ ਨੇ ਉਨ੍ਹਾਂ ਨੂੰ ਅਸੀਂ ਬਹੁਤ ਪ ਸਾਰੇ ਪੰਜਾਬ ਬਹੁਤ ਪਸੰਦ ਕਰਦਾ ਅਤੇ ਸਭ ਤੋਂ ਅੱਛੀ ਗੱਲ ਜਿਹੜੇ ਜਿਹੜੇ ਇੰਸਟਰੂਮੈਂਟ ਨੇ ਜਿਹੜੇ ਭੰਗੜੇ ਦੇ ਅੰਦਰ ਅਸੀਂ ਯੂਜ ਕਰਦੇ ਹਾਂ ਜਿੱਦਾਂ ਢੋਲ ਹੋ ਗਏ ਹੈ ਨਾ ਬਾਂਸੁਰੀ ਹੋ ਗਈ ਪਿਆਨੋ ਹੋ ਗਏ ਹੈ ਸਾਰੀ ਚੀਜ਼ਾਂ ਜ਼ਿਆਦਾ ਮੇਨ ਟਰਡੀਸ਼ਨਲ ਜਿਹੜਾ ਹੈਗਾ ਹੈ ਭੰਗੜੇ ਦੇ ਅੰਦਰ ਢੋਲ ਨੂੰ ਯੂਜ ਕੀਤਾ ਜਾਂਦਾ ਹੈ ਜਿਹਦੇ ਨਾਲ ਅਸੀਂ ਭੰਗੜਾ ਕਰਦੇ ਹਾਂ ਅਤੇ ਜਿਹੜੇ ਸੰਗੀਤਕਾਰ ਨੇ ਜਿਹੜੇ ਵੀ ਅੱਜ ਅਸੀਂ ਦੇਖ ਰਹੇ ਹਾਂ ਉਹ ਬਹੁਤ ਸੰਗੀਤ ਨੂੰ ਅੱਗੇ ਲੈ ਕੇ ਜਾ ਚੁੱਕੇ ਨੇ ਜਿਹਦੇ ਨਾਲ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਸਾਰਾ ਯੂਥ ਬਹੁਤ ਖੁਸ਼ ਹੈ ਅਤੇ ਆਪਣੇ ਪੰਜਾਬ ਦਾ ਜਿਹੜਾ ਕਲਚਰ ਹੈ ਬਹੁਤ ਅੱਗੇ ਸੰਗੀਤ ਨੂੰ ਜਾ ਕੇ ਮੋਟੀਵੇਟ ਕਰ ਰਹੇ ਨੇ ਅਤੇ ਨਾਲ ਨਾਲ ਜਿੰਨੇ ਵੀ ਇੰਸਟਰੂਮੈਂਟ ਹੈ ਉਹ ਯੂਜ ਕੀਤੇ ਜਾ ਰਹੇ ਨੇ ਸਪੈਸ਼ਲੀ ਪ ਢੋਲ ਹੋ ਗਿਆ